ਮੇਰਾ ਯੂਟੀਊਬ 'ਤੇ ਖੁਸ਼ਬੂ ਕਿਚਨ ਚੈਲੇਂਜ ਪਸੰਦੀਦਾਰ ਭੋਜਨ ਵਿਅੰਜਨ ਚੈਨਲ ਹੈ ਜਿਸ ਤੋਂ ਮੈਂ ਬਹੁਤ ਕੁਛ ਸਿੱਖਿਆ ਵਾ ਜਿਵੇਂ ਕਿ ਪਾਓ ਭਾਜੀ ਡੋਸਾ ਬਹੁਤ ਕੁਛ ਛੋਲੇ ਭਟੂਰੇ ਉਹ ਚੈਨਲ ਮੈਨੂੰ ਇੰਸਪੀਰੇਸ਼ਨ ਲੱਗਦਾ ਵਾ ਮੇਰੀ ਕਿਉਂਕਿ ਉਹਨੂੰ ਦੇਖ ਦੇਖ ਕੇ ਮੈਨੂੰ ਮਨ ਕਰਦਾ ਵਾ ਕੁਕਿੰਗ ਕਰਨ ਦਾ ਅਤੇ ਹੁਣ ਮੇਰੀ ਹੋਬੀ ਬਣ ਚੁੱਕੀ ਆ ਕੁਕਿੰਗ ਕਰਨਾ ਔਰ ਉਹ ਰੋਜ਼ ਹੀ ਇੰਨਾ ਕੁਛ ਪਾਉਂਦੇ ਆ ਕਿ ਸਾਨੂੰ ਸਿੱਖਣ ਨੂੰ ਵੀ ਕਿੰਨਾ ਕੁਛ ਮਿਲਦਾ ਵਾ ਕਿ ਸਾਨੂੰ ਕੀ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਬਣਾਉਣ ਵੇਲੇ ਅਤੇ ਕੀ ਕਰਨੀਆ ਅਤੇ ਕੀ ਕਰਨਾ ਚਾਹੀਦਾ ਲਾਈਕ ਸਾਨੂੰ ਜ਼ਿਆਦਾ ਤੇਲ ਨਹੀ ਯੂਜ ਕਰਨਾ ਚਾਹੀਦਾ ਆਪਣੀ ਸਬਜ਼ੀਆਂ 'ਚ ਜੋ ਕਿ ਸਾਡੇ ਲਈ ਨੁਕਸਾਨਦਾਇਕ ਹੈ ਔਰ ਮਸਾਲੇ ਵਗੈਰਾ ਤੋਂ ਬਿਨਾਂ ਹੀ ਉਹ ਕਿੰਨਾ ਕੁਛ ਵਧੀਆ ਸਿਖਾ ਦਿੰਦੇ ਹਨ ਅਤੇ ਸਾਨੂੰ ਉਹ ਕੋਈ ਕੋਰਸ ਕਰਨ ਦੀ ਵੀ ਨਹੀਂ ਲੋੜ ਪੈਂਦੀ ਕੁਕਿੰਗ ਲਈ ਕਿਉਂਕਿ ਉਹ ਇੰਨਾ ਵਧੀਆ ਸਿਖਾਉਂਦੇ ਕਿ ਸਾਨੂੰ ਉਹਨੂੰ ਦੇਖ ਕੇ ਹੀ ਕਿੰਨਾ ਕੁਛ ਸਿੱਖਣ ਲਈ ਮਿਲ ਜਾਂਦਾ ਵਾ ਅਤੇ ਆਪਾਂ ਨੂੰ ਬਹੁਤ ਵਧੀਆ ਕੁਕਿੰਗ ਸਿੱਖਣ ਲਈ ਮਿਲ ਜਾਂਦੀ ਹੈ ਔਰ ਆਪਾਂ ਸਿੱਖ ਵੀ ਲੈਂਦੇ ਹਾਂ ਔਰ ਮੇਰਾ ਐਕਸਪੀਰੀਅਸ ਇਸ ਚੈਨਲ ਨਾਲ ਬਹੁਤ ਵਧੀਆ ਰਿਹਾ ਵਾ ਮੈਂ ਚਾਹੁੰਦੀ ਹਾਂ ਕਿ ਇਹ ਕੰਟੀਨਿਊਸਲੀ ਪਾਉਂਦੇ ਰਹਿਣ ਅਤੇ ਹੋਰ ਵੀ ਵਧੀਆ ਵਧੀਆ ਨਵੀਆਂ ਨਵੀਆਂ ਚੀਜ਼ਾਂ ਸਾਨੂੰ ਸਿਖਾਉਂਦੇ ਰਹਿਣ ਇਹ ਕੇਕ ਬਣਾਉਣਾ ਵੀ ਸਿਖਾਉਂਦੇ ਨੇ ਜੋ ਕਿ ਅੱਜ ਕੱਲ੍ਹ ਕੋਈ ਵੀ ਨਹੀਂ ਸਿਖਾਉਂਦਾ ਇਹ ਹਰ ਇੱਕ ਡਿਟੇਲ ਵਿੱਚ ਜਾਂਦੇ ਨੇ ਡੀਪ ਔਰ ਸਿਖਾਉਂਦੇ ਨੇ ਬਾਕੀ ਚੈਨਲਾਂ ਵਾਲੇ ਇੰਨੇ ਵਧੀਆ ਤਰ੍ਹਾਂ ਨਹੀਂ ਸਿਖਾਉਂਦੇ ਉਹ ਉੱਪਰੋਂ ਉੱਪਰੋਂ ਦੱਸ ਦਿੰਦੇ ਸਾਨੂੰ ਕਿ ਇਹ ਕਰੋ ਇਹ ਨਾ ਇਹ ਨਾ ਪਾਓ ਧੰਨਵਾਦ